ਪੰਜਾਬ ਵਿੱਚ ਕਾਰੋਬਾਰਾਂ ਦੇ ਕਰਨ ਵਾਸਤੇ ਜੋ ਟੈਕਸ ਚੱਲ ਰਿਹਾ ਹੈ ਉਹਦੇ ਵਿੱਚ ਜੀ ਐੱਸ ਟੀ ਹੈ ਜੀ ਐੱਸ ਟੀ ਟੈਕਸ ਜਿਹੜਾ ਕਿ ਵਪਾਰਕ ਤੌਰ 'ਤੇ ਬਹੁਤ ਜ਼ਿਆਦਾ ਹੈਗਾ ਵਪਾਰ ਨੂੰ ਸਰਨ ਕਰਨ ਵਾਸਤੇ ਇਹਦੀ ਟੈਕਸ ਦੀ ਇਹਦੀ ਛੋਟ ਹੋਣੀ ਚਾਹੀਦੀ ਹੈ ਘੱਟ ਹੋਣੀ ਚਾਹੀਦੀ ਹੈ ਦਰ ਇਹਦੀ ਉਹ ਜੋ ਇਨਕਮ ਟੈਕਸ ਅਸੀਂ ਭਰਦੇ ਹਾਂ ਇਨਕਮ ਟੈਕਸ ਦੇ ਵਿੱਚ ਪਹਿਲਾਂ ਮਾਲ ਜਿੱਥੋਂ ਆਉਂਦਾ ਹੈ ਉਹ ਜਮਾਂ ਕਰਦੇ ਹਾਂ ਫਿਰ ਜਿਹੜਾ ਕੁਝ ਸੇਲ ਕਰਦੇ ਹਾਂ ਰਿਟੇਲਰ ਨੂੰ ਵੀ ਅਤੇ ਸਾ ਪੋਲਸੀ ਵਾਲਿਆਂ ਨੂੰ ਦੋਵਾਂ ਨੂੰ ਹੀ ਟੈਕਸ ਭਰਨਾ ਪੈਂਦਾ ਹੈ ਇਹਦੀ ਕੋਈ ਸਰਲ ਪੁਜੀਸ਼ਨ ਹੋਣੀ ਚਾਹੀਦੀ ਹੈ ਜਿਹਦੇ ਨਾਲ ਵਪਾਰਕ ਤੌਰ 'ਤੇ ਸਾਰਿਆਂ ਨੂੰ ਵਪਾਰੀਆਂ ਨੂੰ ਸਹੂਲਤ ਮਿਲੇ ਅਤੇ ਟੈਕਸ ਦੀ ਜਿਹੜੀ ਘਟਾਈ ਕਟ ਘਟਾ ਕੇ ਉਹਦੀ ਜਿਹੜੀ ਕਾਨੂੰਨ ਦੇ ਵਿੱਚ ਨਾ ਸੋਧ ਕਰਨੀ ਚਾਹੀਦੀ ਹੈ ਜਿਹਦੇ ਨਾਲ ਵਪਾਰੀਆਂ ਨੂੰ ਸੌਖਾ ਤਰੀਕਾ ਹੋਵੇ ਅਤੇ ਟੈਕਸ ਵੀ ਘੱਟ ਕਰਨਾ ਭਰਨਾ ਪਏ ਅਤੇ ਉਹਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇ